ਹਾਂਜੀ ਹੈਲੋ ਹਾਂਜੀ ਅਸੀਂ ਐਮਾਜ਼ੋਨ ਤੋਂ ਇੱਕ ਡਿਨਰ ਸੈੱਟ ਜਿਹੜਾ ਉਹ ਬਾਏ ਕੀਤਾ ਸੀ ਮੰਗਵਾਇਆ ਸੀਗਾ ਅਤੇ ਆਨਲਾਈਨ ਔਡਰ ਕੀਤਾ ਸੀਗਾ ਜਿਹੜਾ ਕਿ ਸਾਡੇ ਕੋਲ ਟਾਈਮ 'ਤੇ ਪਹੁੰਚ ਗਿਆ ਜਿਹੜੇ ਉਨ੍ਹਾਂ ਨੇ ਮਿੱਥਿਆ ਜਿਹੜਾ ਸਮਾਂ ਦਿੱਤਾ ਸੀਗਾ ਸਾਨੂੰ ਅਤੇ ਉਹ ਜਦੋਂ ਸਾਡੇ ਕੋਲ ਪਹੁੰਚਿਆ ਪਹਿਲਾਂ ਉਨ੍ਹਾਂ ਦੇ ਕਰਮਚਾਰੀ ਨੇ ਕਨਫਰਮ ਕੀਤਾ ਵੀ ਘਰ ਹੈਗੇ ਹੋ ਜਾਂ ਨਹੀਂ ਹੈਗੇ ਤੁਸੀਂ ਅਤੇ ਫਿਰ ਉਹ ਸਾਡੇ ਘਰ ਆਇਆ ਡਿਲੀਵਰ ਕਰਨ ਦੇ ਲਈ ਅਤੇ ਜਦੋਂ ਮੈਂ ਉਹਨੂੰ ਖੋਲ੍ਹ ਕੇ ਵੇਖਿਆ ਉਹ ਬਿਲਕੁਲ ਡਿਨਰ ਸੈੱਟ ਸੀ ਜਿਹੜਾ ਸੁਰੱਖਿਅਤ ਸੀ ਅਤੇ ਸਾਰੀਆਂ ਚੀਜ਼ਾਂ ਪੂਰੀਆਂ ਸੀ ਗਿਣਤੀ ਪੱਖੋਂ ਵੀ ਅਤੇ ਇਸ ਤੋਂ ਇਲਾਵਾ ਉਹਦੇ ਵਿੱਚ ਸਾਰੇ ਜਿਹੜੇ ਬਹੁਤ ਵਧੀਆ ਕੋਆਲਟੀ ਦਾ ਨਿਕਲਿਆ ਸਾਰੇ ਪਲੇਟਾਂ ਬਹੁਤ ਜ਼ਿਆਦਾ ਸੋਹਣੀਆਂ ਸੀ ਕੋਲੀਆਂ ਗਲਾਸ ਅਤੇ ਚਮਚ ਸਾਰੇ ਬਹੁਤ ਜ਼ਿਆਦਾ ਅੱਛੇ ਸੀਗੇ ਅਤੇ ਉਨ੍ਹਾਂ ਦਾ ਰੇਟ ਵੀ ਜਿਹੜਾ ਹੈਗਾ ਹੈ ਉਹ ਜਾਇਜ਼ ਸੀਗਾ